ਜ਼ਿੰਦਗੀ ਦੇ ਅੰਦਰ ਇਤਿਹਾਸ ਦੇ ਵਿੱਚ ਬਹੁਤ ਵੱਡੇ ਵੱਡੇ ਰਾਜੇ ਹੋਏ ਹਨ ਜਿਵੇਂ ਕਿ ਸਾਡੇ ਦਸ ਗੁਰੂ ਸਹਿਬਾਨਾਂ ਦੇ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਰਹੇ ਹਨ ਜਿਨ੍ਹਾਂ ਨੇ ਧਰਮ ਪ੍ਰਚਾਰ ਨੂੰ ਬਹੁਤ ਉੱਚਾ ਚੱਕਿਆ ਜਾਤ ਪਾਤ ਦਾ ਨਾਸ਼ ਕੀਤਾ ਔਰ ਜ਼ੁਲਮ ਨੂੰ ਵੰਗਾਰਿਆ ਹੈ ਔਰ ਸਦਾ ਮਾਨਵਤਾ ਵਿੱਚ ਜਿਉਣ ਦਾ ਅਧਿਕਾਰ ਦਿੱਤਾ ਹੈ